ਮੈਂ ਆਪਣੇ ਡਾਂਸ ਰੂਟੀਨ ਲਈ ਜ਼ਿਆਦਾਤਰ ਉਹ ਸੰਗੀਤਾਂ ਦੀ ਵਰਤੋਂ ਕਰਦੀ ਹਾਂ ਜਿਹਨਾਂ ਵਿੱਚ ਸੱਭਿਆਚਾਰ ਦੀ ਪੇਸ਼ਕਸ਼ ਹੋਵੇ ਜ਼ਿਆਦਾਤਰ ਮੈਂ ਓਹ ਵਾਲੇ ਸੰਗੀਤ ਵਰਤਦੀ ਹਾਂ ਮਤਲਬ ਜਿਹਨਾਂ 'ਚ ਅਲੱਗ ਸਾਜ ਹੋਵੇ ਅਤੇ ਉਹ ਸਾਜ ਮੇਰੇ ਡਾਂਸ ਨਾਲ ਮਿਲ ਸਕਣ ਅਤੇ ਮੈਂ ਜਦੋਂ ਆਪਣੇ ਸਕੂਲੀ ਤੌਰ 'ਤੇ ਜਦੋਂ ਡਾਂਸ ਪੇਸ਼ ਕਰਦੀ ਸੀ ਉਦੋਂ ਮੈਂ ਜ਼ਿਆਦਾਤਰ ਸੱਭਿਆਚਾਰਕ ਡਾਂਸ ਹੀ ਪੇਸ਼ ਕਰਦੀ ਸੀ ਤਾਂ ਕਿ ਉਹਨਾਂ ਵਿੱਚ ਜਿਹੜੇ ਸਾਜ਼ ਸੰਗੀਤਕ ਸਾਜ਼ ਜਿਹੜੇ ਵਰਤੋਂ ਵਿੱਚ ਲਿਆਉਣੇ ਆਪਾਂ ਉਹ ਉਹਨਾਂ ਨੂੰ ਪਤਾ ਚੱਲ ਜਾਏ ਵੀ ਕਿਹੜੇ ਪੰਜਾਬ ਦੇ ਜਿਹੜੇ ਸੰਗੀਤਕ ਸਾਜ਼ ਆ ਉਹ ਕਿਹੜੇ ਕਿਹੜੇ ਹੁੰਦੇ ਹਨ ਅਤੇ ਇਹਨਾਂ 'ਤੇ ਕਿਵੇਂ ਆਪਣੀ ਡਾਂਸ ਕਰ ਸਕਦੇ ਹਾਂ ਆਪਾਂ ਅਤੇ ਮੈਂ ਬੱਚਿਆਂ ਨੂੰ ਵੀ ਕਈ ਵਾਰੀ ਜਦੋਂ ਭੰਗੜਾ ਸਿਖਾਉਂਦੀ ਹਾਂ ਉਹਨਾਂ ਲਈ ਵੀ ਮੈਂ ਸੱਭਿਆਚਾਰਕ ਸੰਗੀਤ ਹੀ ਵਰਤੋਂ ਵਿੱਚ ਲਿਆਉਂਦੀ ਜਿਵੇਂ ਇੱਧਰ ਹੁਣ ਤੱਕ ਪਹਿਲਾਂ ਮੈਂ ਸੱਭਿਆਚਾਰਕ ਹੀ ਯੂਜ ਕਰਦੀ ਸੀਗੀ ਅਤੇ ਹੁਣ ਜਿਵੇਂ ਇੱਧਰ ਦਾ ਪ੍ਰਸਿੱਧ ਕਲਾਕਾਰ ਹੈਗਾ ਤਰਸੇਮ ਜੱਸੜ ਉਨ ਉਸਦੇ ਸੰਗੀਤ ਮੈਨੂੰ ਬਹੁਤ ਵਧੀਆ ਲੱਗਦੇ ਮੈਂ ਉਸਦੇ ਸੰਗੀਤ ਵਿੱਚ ਬਹੁਤ ਹੀ ਵਧੀਆ ਸਾਜ਼ ਸੁਰ ਤਾਲ ਹੁੰਦੀ ਹੈ ਜਿਹੜੇ ਕਿ ਮੇਰੇ ਡਾਂਸ ਲਈ ਮੈਨੂੰ ਬਹੁਤ ਵਧੀਆ ਲੱਗਦੇ ਤਾਂ ਕਰਕੇ ਮੈਂ ਜ਼ਿਆਦਾਤਰ ਉਹਨਾਂ ਦੇ ਸੰਗੀਤ ਹੀ ਲੈਂਦੀ ਹਾਂ ਡਾਂਸ ਕਰਨ ਲਈ ਅਤੇ ਪੁਰਾਣੇ ਸ ਸੰਗੀਤਕਾਰ ਵਿੱਚੋਂ ਮੈਂ ਅਮਰ ਸਿੰਘ ਚਮਕੀਲਾ ਇਹਨਾਂ ਦੇ ਸੰਗੀਤ ਜ਼ਿਆਦਾ ਆਪਣੇ ਡਾਂਸ ਲਈ ਚੁਣਦੀ ਹਾਂ ਤਾਂ ਕਿ ਮੇਰਾ ਜਿਹੜਾ ਡਾਂਸ ਹੈ ਇਹਨਾਂ ਦੇ ਸਾਜ ਨਾਲ ਮਿਲ ਸਕੇ ਅਤੇ ਮੇਰਾ ਜਿਹੜਾ ਡਾਂਸ ਹੈ ਉਹ ਸੱਭਿਆਚਾਰਕ ਰੂਪ ਵੀ ਪੇਸ਼ ਕਰ ਸਕੇ ਅਤੇ ਸਕੂਲੀ ਬੱਚਿਆਂ ਲਈ ਤਾਂ ਸੱਭਿਆਚਾਰਕ ਪੇਸ਼ ਕਰਨਾ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਉਹਨਾਂ ਨੂੰ ਆਪਣੇ ਸੱਭਿਆਚਾਰ ਦਾ ਵੀ ਧਿਆਨ ਰਵੇ ਤਾਂ ਕਰਕੇ ਮੈਂ ਆਪਣੇ ਸੰਗੀਤ ਆਪਣੇ ਡਾਂਸ ਲਈ ਉਹ ਸੰਗੀਤ ਦੀ ਵਰਤੋਂ ਕਰਦੀ ਹਾਂ ਮਤਲਬ ਜਿਹੜੇ ਕਿ ਮੇਰੇ ਮਨ ਨੂੰ ਵੀ ਖੁਸ਼ੀ ਦੇਣ ਮਤਲਬ ਮੇਰਾ ਮਨ ਵੀ ਉਹਨਾਂ ਵਿੱਚ ਪ੍ਰਸੰਨ ਹੋਵੇ ਉਹ ਡਾਂਸ ਕਰਨ ਲਈ ਮਤਲਬ ਮੇਰੇ ਮਨ ਦੀ ਖੁਸ਼ੀ ਹੋਵੇ ਅਤੇ ਮੇਰੇ ਮਨ ਵਿੱਚ ਉਹ ਸਾਜ਼ ਖੁਦ ਮਿਲ ਸਕਣ ਅਤੇ ਮੇਰੇ ਅੰਦਰੋਂ ਉਹ ਜੋਸ਼ ਖੁਦ ਆਵੇ ਜੋ ਕਿ ਉਹ ਸੰਗੀਤ ਵਿੱਚ ਆ ਰਿਹਾ ਤਾਂ ਕਰਕੇ ਮੈਂ ਤੁਹਾਨੂੰ ਵੀ ਇਹੀ ਕਹਿਣਾ ਚਾਹਾਂਗੀ ਤੁਸੀਂ ਉਹ ਸੰਗੀਤ ਚੁਣੋ ਵੀ ਜਿਹੜੇ ਤੁਹਾਡੇ ਡਾਂਸ ਲਈ ਤੁਹਾਨੂੰ ਖੁਦ ਨੂੰ ਲੱਗੇ ਵੀ ਹਾਂ ਤਾਂ ਇਹ ਸੰਗੀਤ ਸੁਣਨ ਤੋਂ ਬਾਅਦ ਤੁਹਾਡੇ 'ਚ ਵੀ ਜੋਸ਼ ਆ ਰਿਹਾ ਧੰਨਵਾਦ